ਮੈਂ ਹਰ ਰੋਜ਼ ਆਪਣੀ ਰਸੋਈ ਵਿੱਚ ਬਰਤਨਾਂ ਦੀ ਸਫਾਈ ਕਰਦੀ ਹਾਂ ਬਰਤਨਾਂ ਨੂੰ ਚੰਗੀ ਤਰ੍ਹਾਂ ਸਾਫ ਕਰਨ ਦੇ ਲਈ ਮੈਂ ਪਹਿਲਾਂ ਉਹਨਾਂ ਨੂੰ ਗਰਮ ਪਾਣੀ ਨਾਲ਼ ਧੋਂਦੀ ਹਾਂ ਅਤੇ ਫ਼ਿਰ ਸਰਫ ਲਗਾ ਕੇ ਪਾਣੀ ਨਾਲ਼ ਧੋ ਦਿੰਦੀ ਹਾਂ ਤੇਲ ਜਾਂ ਥੰਧਿਆਈ ਵਾਲ਼ੇ ਬਰਤਨਾਂ ਨੂੰ ਪਹਿਲਾਂ ਮੈਂ ਪਾਣੀ ਅਤੇ ਬਾਅਦ ਵਿੱਚ ਚੁੱਲ੍ਹੇ ਦੀ ਸਵਾਹ ਨਾਲ਼ ਚੰਗੀ ਤਰ੍ਹਾਂ ਰਗੜ ਕੇ ਸਾਫ ਕਰਦੀ ਹਾਂ ਅਤੇ ਪਾਣੀ ਨਾਲ਼ ਧੋ ਦਿੰਦੀ ਹਾਂ